ਬੈਂਕ ਬਾਰੇ ਕੁਝ ਮਾੜੇ ਅਨੁਭਵ ਇਹੋ ਹੀ ਹਨ ਕਿ ਕਈ ਵਾਰੀ ਸਾਨੂੰ ਕੁਝ ਪਤਾ ਕਰਨ ਲਈ ਸਟਾਫ ਕੋਲ ਪੁੱਛਣਾ ਪੈਂਦਾ ਹੈ ਅਤੇ ਉਹ ਬਿਜ਼ੀ ਹੋਣ ਕਰਕੇ ਜਾਂ ਕਿਸੇ ਹੋਰ ਕੰਮ 'ਚ ਰੁੱਝੇ ਹੋਣ ਕਰਕੇ ਸਾਨੂੰ ਟਾਲਮਟੋਲ ਕਰਦੇ ਕਰ ਦਿੰਦੇ ਹਨ ਅਤੇ ਕਹਿੰਦੇ ਹਨ ਕਿ ਕੱਲ੍ਹ ਫੇਰ ਆਇਓ ਬਸ ਇਹੋ ਹੀ ਮਾੜੇ ਅਨੁਭਵ ਹਨ ਅਤੇ ਲੰਬੀਆਂ ਕਤਾਰਾਂ ਵੀ ਮਾੜੇ ਅਨੁਭਵ ਹਨ ਜਿਸ ਜਗ੍ਹਾ ਵਿੱਚ ਦੋ ਵਿੰਡੋ ਹੋਵੇ ਉਸ ਜਗ੍ਹਾ ਵਿੱਚ ਕੰਮ ਜਲਦੀ ਹੋ ਜਾਂਦਾ ਹੈ ਜੇਕਰ ਇੱਕੋ ਵਿੰਡੋ ਨਾਲ ਸਾਰੇ ਕੰਮ ਹੋਣ ਅਤੇ ਉਸ ਵਿੱਚ ਲੰਬੀ ਕਤਾਰ ਲੱਗੀ ਹੋਣ ਕਰਕੇ ਵੀ ਸਮਾਂ ਲੱਗ ਜਾਂਦਾ ਹੈ ਜੋ ਕਿ ਇੱਕ ਮਾੜਾ ਅਨੁਭਵ ਹੈ